ਸਤਿ ਸ਼੍ਰੀ ਅਕਾਲ ਜੀ ਰਾਮ ਟੈਕਸੀ ਸਰਵਿਸ ਤੋਂ ਵਿਨੋਦ ਜੀ ਗੱਲ ਕਰ ਰਹੇ ਮੈਂ ਰੋਪੜ ਤੋਂ ਸਿਮਰਨਜੀਤ ਗੱਲ ਕਰ ਰਿਹਾ ਜੀ ਮਨਜੀਤ ਮਾਮਾ ਜੀ ਨੇ ਤੁਹਾਡਾ ਨੰਬਰ ਦਿੱਤਾ ਸੀ ਅਸੀਂ ਪਰਸੋਂ ਨੂੰ ਰੋਪੜ ਤੋਂ ਆਨੰਦਪੁਰ ਸਾਹਿਬ ਜਾਣਾ ਹੈ ਜੀ ਰਸਤਾ ਲਗਭਗ ਚਾਲੀ ਕੁ ਕਿਲੋਮੀਟਰ ਹੈ ਅਤੇ ਰਸਤੇ ਵਿੱਚ ਜੇ ਕੋਈ ਢਾਬਾ ਖਾਣ ਪੀਣ ਦੀ ਜਗ੍ਹਾ ਹੋਈ ਹ ਕੁਛ ਦੇਰ ਅਸੀਂ ਉੱਥੇ ਵੀ ਰੁਕਾਂਗੇ ਅਤੇ ਕੋਈ ਕੁਝ ਬੱਚਿਆਂ ਦੇ ਲਈ ਖੇਡਣ ਦਾ ਪਾਰਕ ਵਗੈਰਾ ਹੋਇਆ ਥੋੜ੍ਹਾ ਟਾਈਮ ਉੱਥੇ

ਜੇ ਅੱਗੇ ਫੇਰ ਨਹਿਰ ਵਗੈਰਾ ਕਿਤੇ ਕੁਝ ਹੋਇਆ ਅਤੇ ਉੱਥੇ ਵੀ ਕੁਝ ਥਾਂ ਅਸੀਂ ਫੋਟੋਆਂ ਵਗੈਰਾ ਖਿੱਚਵਾ ਖਿੱਚਵਾਉਣੀਆਂ ਨੇ ਸਾਨੂੰ ਚਾਰ ਸੀਟਰ ਅਤੇ ਛੇ ਸੀਟਰ ਦੇ ਲਈ ਦੋਨਾਂ ਦੇ ਕੈਬਾਂ ਦਾ ਕਿੰਨਾ ਕਿਰਾਇਆ ਲੱਗੇਗਾ ਸਾਨੂੰ ਇਸਦੀ ਜਾਣਕਾਰੀ ਦੇ ਦਿਉ ਤਾਂ ਕਿ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਸਕੀਏ ਧੰਨਵਾਦ